ਹੈਲੋ ਸਤਿ ਸ਼੍ਰੀ ਅਕਾਲ ਭਾਅ ਜੀ ਮੈਂ ਨਾ ਰਜਨੀਸ਼ ਕੁਮਾਰ ਹਾਂ ਤਾਂ ਮੈਂ ਨਾ ਗੁਰਦਾਸਪੁਰ 'ਚ ਨਵਾਂ ਬੰਦਾ ਰਹਿ ਸ਼ਹਿ ਇਹ ਸ਼ਹਿਰ ਮੇਰੇ ਵਾਸਤੇ ਨਵਾਂ ਅਤੇ ਮੈਂ ਇੱਥੇ ਮੈਂ ਰਹਿਣ ਆਇਆ ਜੇ ਅਤੇ ਭਾਅ ਜੀ ਮੈਂ ਸੁਣਿਆ ਫਿਸ਼ ਪਾਰਕ ਬੜੀ ਵਧੀਆ ਘੁੰਮਣ ਵਾਲੀ ਜਗ੍ਹਾ ਕੁਛ ਦੱਸੋ ਉਹਦੇ ਬਾਰੇ

ਹਾਂਜੀ ਅੱਛਾ ਜੀ ਠੀਕ ਹੈ ਜੀ ਅੱਛਾ ਅੱਛਾ ਠੀਕ ਹੈ ਹਾਂਜੀ ਭਾਅ ਜੀ ਠੀਕ ਹੈ ਭਾਅ ਜੀ ਉਹ ਤਾਂ ਗੱਲ ਹੈ ਹਾਂਜੀ ਹਾਂਜੀ ਉਹ ਤਾਂ ਗੱਲ ਹੈ ਠੀਕ ਹੈ ਭਾਅ ਜੀ ਕੋਈ ਕੋਈ ਨਹੀਂ ਜੀ ਕੋਈ ਨਹੀਂ ਧੰਨਵਾਦ ਭਾਅ ਜੀ ਦੱਸਣ ਵਾਸਤੇ ਓਕੇ ਬਾਏ